ਮੈਂ ਸਟਿਚਿੰਗ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹਾਂ ਅਤੇ ਇੱਕ ਦਿਨ ਐਵੇਂ ਹੀ ਫਾਰਮ ਭਰੇ ਜਾ ਰਹੇ ਸਨ ਅਤੇ ਮੇਰੇ ਘਰ ਦੇ ਮੈਨੂੰ ਕਹਿ ਰਹੇ ਸੀ ਕਿ ਤੂੰ ਵੀ ਜਾ ਕੇ ਫਾਰਮ ਭਰਿਆ ਆਂਗਨਵਾੜੀ ਦੀ ਨੌਕਰੀ ਲਈ ਫਾਰਮ ਭਰੇ ਜਾ ਰਹੇ ਸਨ ਪਰ ਮੈਂ ਮੇਰਾ ਮਨ ਨਹੀਂ ਮੰਨਿਆ ਕਿਉਂਕਿ ਮੇਰੀ ਐਨੀ ਕੁਆਲੀਫਿਕੇਸ਼ਨ ਨਹੀਂ ਸੀ ਕਿ ਮੈਂ ਆਂਗਨਵਾੜੀ ਦੀ ਨੌਕਰੀ ਲਈ ਫਾਰਮ ਭਰ ਸਕਾ ਪਰ ਘਰਦਿਆਂ ਦੇ ਕਹਿਣ ਤੋਂ ਬਾਅਦ ਵੀ ਮੈਂ ਨਹੀਂ ਗਈ ਅਤੇ ਉਹਨਾਂ ਨੇ ਐਵੇਂ ਹੀ ਜਾ ਕੇ ਮੇਰਾ ਫਾਰਮ ਲੈ ਆਏ ਘਰੇ ਅਤੇ ਫਾਰਮ ਭਰਤਾ ਅਤੇ ਫਾਰਮ ਭਰ ਕੇ ਦੇ ਤਾ ਅਤੇ ਉਸ ਤੋਂ ਬਾਅਦ ਮੈਂ ਨੌਕਰੀ ਬਾਰੇ ਕੁਛ ਕੁਝ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਅਤੇ ਮੈਂ ਆਪਣਾ ਸਟਿਚਿੰਗ ਅਤੇ ਬਿਊਟੀ ਪਾਲਰ ਦਾ ਕੰਮ ਕਰਦੀ ਰਹੀ ਅਤੇ ਅਚਾਨਕ ਹੀ ਇੱਕ ਦਿਨ ਇੱਕ ਲੈਟਰ ਆਇਆ ਅਤੇ ਜਦੋਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਮੈਂ ਬਹੁਤ ਹੈਰਾਨ ਹੋਈ ਕਿਉਂਕਿ ਆਂਗਣਵਾੜੀ ਦੀ ਨੌਕਰੀ ਲਈ ਜਿਹੜਾ ਮੈਂ ਫਾਰਮ ਭਰਿਆ ਸੀ ਉਹ ਉਹਦਾ ਜਵਾਬ ਸੀ ਅਤੇ ਮੈਨੂੰ ਨੌਕਰੀ ਮਿਲ ਗਈ ਸੀ ਅਤੇ ਮੈਨੂੰ ਇਸ ਚੀਜ਼ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਮੈਂ ਕਦੇ ਆਂਗਣਵਾੜੀ ਵਿੱਚ ਨੌਕਰੀ ਵੀ ਕਰਾਂਗੀ ਮੈਨੂੰ ਇਹ ਸੀ ਕਿ ਮੈਂ ਸਟਿਚਿੰਗ ਅਤੇ ਬਿਊਟੀ ਪਾਰਲਰ ਦਾ ਕੰਮ ਕੀ ਕਰਦੀ ਹਾਂ ਅਤੇ ਉਹੀ ਕਰਦੀ ਰਹਾਂਗੀ ਪਰ ਮੈਨੂੰ ਆਂਗਣਵਾੜੀ ਵਿੱਚ ਨੌਕਰੀ ਮਿਲ ਗਈ